ਬਜ਼ੁਰਗ ਲੋਕ ਵਿਹਲੇ ਟਾਈਮ ਵਿੱਚ ਬਹੁਤ ਖੇਡਾਂ ਖੇਡਦੇ ਹਨ ਪੰਜਾਬ ਵਿੱਚ ਅਕਸਰ ਬਜ਼ੁਰਗ ਲੋਕ ਪਿੰਡਾਂ ਦੀ ਸੱਥ ਵਿੱਚ ਬੈਠ ਬੈਠੇ ਤਾਸ਼ ਖੇਡਦੇ ਮਿਲ ਜਾਂਦੇ ਹਨ ਇਸ ਖੇਡ ਨੂੰ ਵੱਧ ਤੋਂ ਵੱਧ ਲੋਕ ਵੀ ਖੇਡ ਸਕਦੇ ਹਨ ਤਾਸ਼ ਵਿਚ ਕਈ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ ਜਿਵੇਂ ਕੀ ਭਾਬੀ ਦਿਉਰ ਸੀਪ ਚੌਸਰ ਤਿੰਨ ਦੋ ਪੰਜ ਹੋਰ ਵੀ ਇਹ ਖੇਡ ਖੇਡਦੇ ਹਨ ਸਮੇਂ ਪਿੰਡ ਦੇ ਹੋਰ ਲੋਕ ਵੀ ਸੱਥ ਵਿੱਚ ਖੜ੍ਹ ਕੇ ਖੇਡ ਦਾ ਆਨੰਦ ਮਾਣਦੇ ਹਨ ਬਾਕੀ ਬਜ਼ੁਰਗਾਂ ਲਈ ਹੋਰ ਵੀ ਖੇਡਾਂ ਹਨ ਜਿਵੇਂ ਕਿ ਜਦੋਂ ਕੋਈ ਕਬੱਡੀ ਟੂਰਨਾਮੈਂਟ ਹੁੰਦਾ ਸੀ ਤਾਂ ਬਾਅਦ ਵਿੱਚ ਸਾਰੇ ਬਜ਼ੁਰਗ ਇਕੱਠੇ ਕਰਕੇ ਕੁੱਕੜ ਛੱਡਿਆ ਜਾਂਦਾ ਸੀ ਅਤੇ ਜੋ ਕੁੱਕੜ ਫੜ ਲੈਂਦਾ ਸੀ ਤਾਂ ਕੁੱਕੜ ਉਸਦਾ ਹੋ ਜਾਂਦਾ ਸੀ